ਪੰਜਾਬ ਦੀ ਮੇਨ ਖੇਡ ਹੈਗੀ ਹੈ ਜੀ ਹੋਕੀ ਹੋਕੀ ਵਿੱਚ ਦੋਵੇਂ ਟੀਮਾਂ ਦੇ ਪਲੇਅਰ ਐਕਟੀਵੇਟ ਰਹਿੰਦੇ ਹੈ ਦੋਵੇਂ ਇੱਕ ਦੂਜੇ ਦੇ ਹੋਕੀ ਰਾਹੀਂ ਬੋਲ ਖਿੱਚਣ ਦੀ ਕੋਸ਼ਿਸ਼ ਕਰਦੇ ਅਤੇ ਗੋਲ ਕਰਨ ਦੀ ਕੋਸ਼ਿਸ਼ ਕਰਦੇ ਹੈ ਪੰਜਾਬ ਦਾ ਮੇਨ ਖਿਲਾੜੀ ਹੋਇਆ ਹੈ ਪ੍ਰਗਟ ਸਿੰਘ ਜਿਸ ਨੇ ਆਪਣੀ ਹੋਕੀ ਤੋਂ ਬੋਲ ਅਲੱਗ ਨਹੀਂ ਹੋਣ ਦਿੰਦਾ ਸੀ ਅਤੇ ਬਹੁਤ ਇੰਡੀਆ ਦੀ ਟੀਮ ਨੂੰ ਬਹੁਤ ਮੈਚ ਉਹਨਾਂ ਨੇ ਜਿੱਤ ਹਾਸਿਲ ਕਰਵਾਈ ਅਤੇ ਇਹੀ ਮੈਚ ਉਹੋ ਜਿਹਾ ਹੈ ਜਿਦੇ 'ਚ ਦੋਵੇਂ ਪਲੇਅਰ ਸਾਰੇ ਦੇ ਸਾਰੇ ਖੇਡਦੇ ਹੁੰਦੇ ਆ ਅਤੇ ਬਾਕੀ ਅਗਰ ਕ੍ਰਿਕਟ ਦਾ ਲਾ ਲਓ ਉਹਦੇ 'ਚ ਇੱਕ ਬੰਦਾ ਖੇਡ ਰਿਹਾ ਬਾਕੀ ਸਾਰੇ ਦੇਖ ਰਹੇ ਇਹਦੇ 'ਚ ਸਾਰੀਆਂ ਹੀ ਪਲੇਅਰ ਆਪਸ 'ਚ ਖੇਡ ਰਹੇ ਹੁੰਦੇ ਹੈ